ਸਤਿ ਸ਼੍ਰੀ ਅਕਾਲ ਜੀ ਬੋਲਦੇ ਪਏ ਹਾਂਜੀ ਮੈਂ ਮੈਨੂੰ ਜਰਾ ਥੋੜ੍ਹੀ ਪ੍ਰੋਬਲਮ ਸੀਗੀ ਅੱਜ ਕੱਲ੍ਹ ਬੜਾ ਖਾਂਸੀ ਜ਼ੁਕਾਮ ਜਿਹਾ ਗਲੇ 'ਚ ਖਰਾਸ਼ ਜਿਹੀ ਹੋ ਰਹੀ ਹੈ ਤਾਂ ਦਵਾਈ ਪੁੱਛਣੀ ਸੀ ਕਿਹੜੀ ਮਿਲ ਸਕਦੀ ਹੈ ਠੀਕ ਹੈ ਮ ਇੱਧਰਲੇ ਪਾਸੇ ਜਰਾ ਥੋੜ੍ਹੀ ਪਲਿਊਸ਼ਨ ਦੀ ਪ੍ਰੋਬਲਮ ਹੈਗੀ ਹੈ ਤਾਂਕਿ ਇਹਦੇ ਨਾਲ ਫਿਰ ਥੋੜ੍ਹਾ ਹੋ ਜਾਂਦਾ ਥੋੜ੍ਹਾ ਬਹੁਤ ਮਤਲਬ ਸਾਹ 'ਚ ਵੀ ਪ੍ਰੋਬਲਮ ਆ ਰਹੀ ਫਿਰ ਉਹਦੇ ਕਰਕੇ ਠੀਕ ਆ ਅਤੇ ਹੋਰ ਕੋਈ ਇਲਾਜ ਜੇ ਕਿਤੇ ਟੈਸਟ ਟੁਸਟ ਦੀ ਜ਼ਰੂਰਤ ਪਵੇ ਤਾਂ ਕਿਹੜੇ ਕਰਵਾ ਲਈਏ ਅੱਛਾ ਅਤੇ ਹੋਰ ਵੀ ਪ੍ਰੋਬਲਮ ਸੀਗੀ ਕਿ ਪਿੱਛੇ ਜਰਾ ਹੱਡੀ ਜਿ ਮੇਰੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਦਰਦ ਕਰਦੀ ਹੈ ਉਹ ਜਰਾ ਵੇਟ ਚੁੱਕਣ ਕਰਕੇ ਥੋੜ੍ਹਾ ਹੋ ਗਿਆ ਤਾਂ ਉਹਦਾ ਕੀ ਇਲਾਜ ਹੋ ਸਕਦਾ ਐਕਸਰੇ ਉਕਸੁਰੇ ਦੀ ਲੋੜ ਤਾਂ ਨਹੀਂ ਪਵੇਗੀ ਅੱਛਾ ਤਾਂ ਉਹਦੇ 'ਚ ਕੀ ਹੁੰਦਾ ਮਤਲਬ ਅੱਛਾ ਠੀਕ ਹੈ ਮਤਲਬ ਉਹਦੇ ਨਾਲ ਸਾਰਾ ਕੁਛ ਦਿਖ ਜਾਂਦਾ ਹੱਡੀ ਕਿਸ ਪਾਸੇ ਨੂੰ ਜਾਂ ਫਿਰ ਕਿੱਦਾਂ ਵੀ ਹੈ ਠੀਕ ਹੈ ਅੱਛਾ ਠੀਕ ਹੈ ਮਤਲਬ ਗਰਮ ਪਾਣੀ ਵਗੈਰਾ ਪੀ ਕੇ ਗਰਮ ਪਾਣੀ ਵਗੈਰਾ ਨਾ ਪੀਈਏ ਬਸ ਹੈਨਾ ਜਿੱਦਾਂ ਅਦਰਕ ਵਗੈਰਾ ਪਾ ਕੇ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੇ ਹੋਸਪਿਟਲ ਆ ਜਾਵਾਂਗੇ ਤੁਸੀਂ ਐਕਸਰੇ ਵਗੈਰਾ ਕਰ ਦਿਓ ਠੀਕ ਹੈ ਓਕੇ ਧੰਨਵਾਦ ਧੰਨਵਾਦ ਧੰਨਵਾਦ